ਸਾਡੇ ਪਿੰਡਾਂ 'ਚ ਵਿਆਹਾਂ ਦੀ ਦੌਰਾਨ ਸਭ ਤੋਂ ਮਹੱਤਵਪੂਰਨ ਰੋਲ ਜੋ ਹੁੰਦਾ ਹੈ ਉਹ ਇੱਕ ਵਿਚੋਲੇ ਦਾ ਹੁੰਦਾ ਜਦੋਂ ਵੀ ਕੋਈ ਵਿਆਹ ਹੋਣਾ ਹੁੰਦਾ ਹੈ ਅਤੇ ਇੱਕ ਵਿਚੋਲਾ ਜਿਹਨੂੰ ਜੋ ਕਿ ਵਿਚਕਾਰ ਵਾਲਾ ਬੰਦਾ ਹੁੰਦਾ ਹੈ ਦੋਵਾਂ ਭਰਾ ਪਰਿਵਾਰਾਂ ਦਾ ਮੇਲ ਕਰਵਾਉਣ ਵਾਲਾ ਹੁੰਦਾ ਸੋ ਉਹ ਵਿਚੋਲਾ ਇੱਕ ਬੰਦੇ ਨੂੰ ਦੂਸਰੇ ਬੰਦੇ ਇੱਕ ਪਰਿਵਾਰ ਨੂੰ ਦੂਸਰੇ ਪਰਿਵਾਰ ਨਾਲ ਮਿਲਾਉਂਦਾ ਹੈ ਅਤੇ ਵਿਆਹ ਤੋਂ ਪਹਿਲਾਂ ਸਾਰੀ ਜਾਣਕਾਰੀ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਨੂੰ ਮੁੰਡੇ ਜਾਂ ਕੁੜੀ ਬਾਰੇ ਦਿੰਦਾ ਹੈ ਜਦੋਂ ਮੁੰਡੇ ਜਾਂ ਕੁੜੀ ਦੇ ਪਰਿਵਾਰ ਨੂੰ ਮੁੰਡਾ ਕੁੜੀ ਦੋਨੋਂ ਪਸੰਦ ਹੁੰਦੇ ਦੋਨੋਂ ਪਰਿਵਾਰ ਉਸ ਵਿਚੋਲੇ ਨੂੰ ਦੱਸਦੇ ਨੇ ਕਿ ਸਾਨੂੰ ਬੱਚਾ ਪਸੰਦ ਹੈ ਤਾਂ ਇੱਕ ਦਿਨ ਕੋਈ ਮਿੱਥਿਆ ਜਾਂਦਾ ਹੈ ਜਿੱਥੇ ਦੋਨੇ ਪਰਿਵਾਰ ਰਾਜ਼ੀ ਹੁੰਦੇ ਹਨ ਇੱਕ ਜਗ੍ਹਾ ਮਿੱਥੀ ਜਾਂਦੀ ਹੈ ਸੋ ਉਸ ਜਗ੍ਹਾ ਦੇ ਉੱਪਰ ਦੋਨੋਂ ਪਰਿਵਾਰਾਂ ਨੂੰ ਲੈ ਕੇ ਵਿਚੋਲਾ ਨਾਲ ਖੁਦ ਆਉਂਦਾ ਹੈ ਉੱਥੇ ਬੈਠ ਕੇ ਫਿਰ ਇੱਕ ਦੂਸਰੇ ਨੂੰ ਪਸੰਦ ਕਰਨ ਬਾਰੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਹਨ ਜਦੋਂ ਦੋਨਾਂ ਪਰਿਵਾਰਾਂ ਦੀ ਇੱਕ ਦੂਸਰੇ ਪ੍ਰਤੀ ਸੰਤੁਸ਼ਟੀ ਚੰਗੀ ਤਰ੍ਹਾਂ ਹੋ ਜਾਂਦੀ ਹੈ ਕਿ ਹਾਂ ਲੜਕਾ ਜਾਂ ਲੜਕੀ ਸਾਡੇ ਲਾਇਕ ਨੇ ਜਾਂ ਅਸੀਂ ਇਹਨਾਂ ਨਾਲ ਰਿਸ਼ਤਾ ਬਣਾ ਸਕਦੇ ਹਾਂ ਤਾਂ ਫਿਰ ਉੱਥੇ ਰੋਕੇ ਦੀ ਰਸਮ ਅਦਾ ਕੀਤੀ ਜਾਂਦੀ ਹੈ ਰੋਕੇ ਦੀ ਰਸਮ ਜੋ ਹੈ ਉਹ ਇੱਕ ਪਰੀ ਇੱਕ ਪਰੰਪਰਾ ਹੈ ਜਿਹਦੇ ਦੌਰਾਨ ਰੋਕ ਲਿਆ ਜਾਂਦਾ ਹੈ ਰੋਕਣਾ ਮਤਲਬ ਕਿ ਮੁੰਡੇ ਜਾਂ ਕੁੜੀ ਨੂੰ ਇੱਕ ਦੂਸਰੇ ਨਾਲ ਰੋਕ ਕੇ ਉਹਨਾਂ ਨੂੰ ਸ਼ਗਨ ਪਾ ਦਿੱਤਾ ਜਾਂਦਾ ਹੈ ਉਹ ਸ਼ਗਨ ਪਾ ਕੇ ਮੂੰਹ ਮਿੱਠਾ ਕਰਾ ਕੇ ਇੱਕ ਦੂਜੇ ਨਾਲ ਮਠਿਆਈ ਸਾਂਝੀ ਕਰ ਲੈਂਦੇ ਹਨ ਜਿਹਦਾ ਮਤਲਬ ਇਹ ਹੁੰਦਾ ਹੈ ਕਿ ਮੁੰਡਾ ਅਤੇ ਕੁੜੀ ਦੋਨਾਂ ਨੂੰ ਰੋਕ ਲਿਆ ਗਿਆ ਹੈ ਉਸ ਦਿਨ ਤੋਂ ਦੋਨਾਂ ਦਾ ਰਿਸ਼ਤਾ ਜੋ ਇੱਕ ਦੂਸਰੇ ਨਾਲ ਹੋ ਜਾਂਦਾ ਹੈ ਸੋ ਇਹ ਸਭ ਤੋਂ ਪਹਿਲੀ ਸ਼ੁਰੂਆਤ ਹੁੰਦੀ ਹੈ ਇੱਕ ਵਿਆਹ ਦੇ ਲਈ ਜਾਂ ਇੱਕ ਰਿਸ਼ਤੇ ਦੇ ਲਈ ਉਸ ਮੀਟਿੰਗ ਦੇ ਵਿੱਚ ਇੱਕ ਦੂਸਰੇ ਨਾਲ ਬੈਠ ਕੇ ਸ਼ਗਨ ਪਾ ਕੇ ਅਤੇ ਇਹ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਪਿਆਰ ਦਿੱਤਾ ਜਾਂਦਾ ਹੈ ਮਿਠਾਈਆਂ ਖਵਾਈਆਂ ਜਾਂਦੀਆਂ ਹਨ ਸ਼ਗਨ ਪਾਏ ਜਾਂਦੇ ਹਨ ਅਤੇ ਦੋਨਾਂ ਦਾ ਰਿਸ਼ਤਾ ਪੱਕਾ ਕੀਤਾ ਜਾਂਦਾ ਹੈ ਸੋ ਇੰਨਾ ਕੁ ਹੈ ਇੰਨੀ ਕੁ ਵਿਧੀ ਇਹ ਜਿਹੜੀ ਵਿਆਹ ਦੀ ਹੁੰਦੀ ਹੈ